ਹੈਲੋ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੰਜਨਾ ਹੈ ਮੈਂ ਆਪਣੇ ਸਹੀਦ ਭਗਤ ਸਿੰਘ ਨਗਰ ਬਾਰੇ ਤੁਹਾਨੂੰ ਕੁਛ ਜਾਣਕਾਰੀ ਦੇਣਾ ਚਾਹੁੰਦੀ ਹਾਂ ਹਾਂ ਭਗਤ ਸਿੰਘ ਨਗਰ ਵਿੱਚ ਮੈਂ ਰਹਿੰਦੀ ਹਾਂ ਇਹ ਇਸ ਵਿੱਚ ਬਹੁਤ ਸਾਰੇ ਮਤਲਬ ਉਦਯੋਗਿਕ ਖੇਤਰ ਹਨ ਇਸ ਵਿੱਚ ਮਤਲਬ ਕਾਫੀਆਂ ਕਾਫੀ ਫੈਕਟਰੀਆਂ ਹਨ ਜਿੱਥੇ ਮਤਲਬ ਸਾਰੇ ਮਤਲਬ ਕਿ ਲੋੜੀਂਦੇ ਪਰਿਵਾਰ ਦੇ ਉੱਥੇ ਕੰਮ ਕਰਦੇ ਹਨ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਹੁੰਦਾ ਹੈ ਅਤੇ ਇੱਥੇ ਕਾਫੀਆਂ ਫੈਕਟਰੀਆਂ ਹਨ ਕੱਪੜਿਆਂ ਦੀਆਂ ਫੈਕਟਰੀਆਂ ਹਨ ਦਵਾਈਆਂ ਦੀਆਂ ਫੈਕਟਰੀਆਂ ਹਨ ਜਿੱਥੇ ਕਿ ਮਤਲਬ ਰੁਜ਼ਗਾਰ ਉੱਥੇ ਮਤਲਬ ਕੰਮ ਕਰਦੇ ਹਨ ਅਤੇ ਵਧੀਆ ਤੋਂ ਵਧੀਆ ਤਰੀਕੇ 'ਤੇ ਅੱਗੇ ਪੁੱਜਦੇ ਹਨ ਅਤੇ ਹੋਰ ਵੀ ਮਤਲਬ ਜਿਨ੍ਹਾਂ ਦੇ ਲੋੜਵੰਦ ਹਨ ਉਹਨਾਂ ਨੂੰ ਦਵਾਈਆਂ ਦੀ ਮਤਲਬ ਲੋੜ ਹੁੰਦੀ ਉਹਨਾਂ ਨੂੰ ਦਵਾਈਆਂ ਪਹੁੰਚਾਉਂਦੇ ਹਨ ਅਤੇ ਇੱਥੇ ਖੇਤੀਬਾੜੀ ਦਾ ਹੈਗਾ ਸਾਡੇ ਮਤਲਬ ਇੱਥੇ ਪੰਜਾਬ ਵਿੱਚ ਕਾਫੀ ਖੇਤੀਬਾੜੀ ਦੇ ਉਹ ਹਨ ਖੇਤੀ ਕਰਦੇ ਹਨ ਅਤੇ ਕਾਫੀ ਤੋਂ ਕਾਫੀ ਇੱਥੇ ਕਣਕ ਦੀ ਰੁਜ਼ਗਾਰੀ ਬਹੁਤ ਵਧੀਆ ਹੁੰਦੀ ਹੈ ਅਤੇ ਆਲੂਆਂ ਦੀਆਂ ਵੀ ਕਾਫੀ ਉਹ ਹੁੰ ਖੇਤੀ ਹੁੰਦੀ ਹੈ ਬਹੁਤ ਵਧੀਆ ਫਸਲ ਹੁੰਦੀ ਹੈ ਇੱਥੇ ਤਾਂ ਫਿਰ ਜ ਅੱਗੇ ਤੋਂ ਅੱਗੇ ਸਾਡੇ ਲੋੜੀਂਦੇ ਮਤਲਬ ਜਿੱਥੇ ਦੇਸ਼ਾਂ ਵਿੱਚ ਕਣਕ ਦੀ ਨਹੀਂ ਰੁਜ਼ਗਾਰੀ ਹੁੰਦੀ ਹੈ ਉੱਥੇ ਭੇਜੀ ਜਾਂਦੀ ਹੈ ਅਤੇ ਸਾਡੇ